ਪੰਜਾਬ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਜੇ ਗੱਲ ਸਿੱਖ ਧਰਮ ਦੀ ਕੀਤੀ ਜਾਵੇ ਤਾਂ ਉਹ ਗਰੀਬਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਹੀ ਵੀਹ ਰੁਪਏ ਦੇ ਨਾਲ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਜੋ ਕਿ ਅੱਜ ਤੱਕ ਚੱਲ ਰਹੀ ਹੈ ਹਰ ਗੁਰਦੁਆਰੇ ਦੇ ਵਿੱਚ ਹਰ ਟਾਈਮ ਲੰਗਰ ਉਪਲਬਧ ਹੁੰਦਾ ਹੈ ਇੱਥੇ ਕਿਸੇ ਦੇ ਨਾਲ ਕੋਈ ਜਾਤ ਪਾਤ ਦਾ ਭੇਦ ਭਾਵ ਨਹੀਂ ਕੀਤਾ ਜਾਂਦਾ ਸੰਗਤ ਨੂੰ ਇੱਕ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ ਅਤੇ ਜੇ ਗੱਲ ਸਾਡੀ ਇੱਕ ਖਾਲਸਾ ਏਡ ਆ ਜਿਹੜੀ ਕਿ ਹਰ ਸਮੇਂ ਮਦਦ ਲਈ ਤਿਆਰ ਰਹਿੰਦੀ ਹੈ ਕਿਤੇ ਵੀ ਕਿਸੇ ਵੀ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਕੋਈ ਵੀ ਪ੍ਰੋਬਲਮ ਆਈ ਹੋਵੇ ਵਾੜ ਆਈ ਹੋਵੇ ਭੂਚਾਲ ਆਇਆ ਹੋਵੇ ਕੋਈ ਵੀ ਨੁਕਸਾਨ ਹੋਇਆ ਹੋਵੇ ਤਾਂ ਉਹ ਖਾਲਸਾ ਏਡ ਜਿਹੜੀ ਆ ਹਰ ਸਮੇਂ ਮਦਦ ਲਈ ਤਿਆਰ ਰਹਿੰਦੀ ਹੈ ਉੱਥੇ ਲੋਕਾਂ ਨੂੰ ਖਾਣਾ ਕੱਪੜੇ ਪਾਣੀ ਵਗੈਰਾ ਦਵਾਈਆਂ ਸਭ ਕੁਛ ਖਾਲਸਾ ਏਡ ਵੱਲੋਂ ਦਿੱਤਾ ਜਾਂਦਾ ਹੈ